ਮੈਂ ਆਪਣੇ ਦੋਸਤਾਂ ਨਾਲ ਗਿਆ ਸੀ ਮੇਰਾ ਬਾਹਰ ਗਿਆ ਹੋਇਆ ਸੀ ਅਤੇ ਮੇਰਾ ਰੀਚਾਰਜ ਮੁੱਕ ਗਿਆ ਸੀ ਉਸ ਤੋਂ ਬਾਅਦ ਮੈਂ ਅਤੇ ਮੇਰਾ ਰਿਚਾਰਜ ਖਤਮ ਹੋ ਗਿਆ ਬਹੁਤ ਸਾਰੀਆਂ ਮੁਸ਼ਕਿਲਾਂ ਆਈਆਂ ਅਤੇ ਮੈਂ ਫੋਟੋਆਂ ਵਗੈਰਾ ਯਾਰ ਦੋਸਤਾਂ ਨਾਲ ਸਾਂਝੀਆਂ ਕਰਨੀਆਂ ਸੀ ਅਤੇ ਉਹ ਕਰ ਨਹੀਂ ਪਾ ਰਹੇ ਸੀ ਬਹੁਤ ਮੁਸ਼ਕਿਲਾਂ ਆਈਆਂ ਇਸ ਲਈ ਮੈਂ ਆਪ ਆਪਦੇ ਫੋਨ ਦਾ ਰੀਚਾਰਜ ਕਰਾਉਣਾ ਚਾਹੁੰਦਾ ਸੀ ਮੈਨੂੰ ਆਪਣੇ ਕੰਮਾਂ ਵਿੱਚ ਵੀ ਬਹੁਤ ਅੜਚਣਾ ਆਈਆਂ ਮੇਰਾ ਫੋਨ 'ਚ ਰੀਚਾਰਜ ਨਾ ਹੋਣ ਕਰਕੇ ਨਾ ਮੈਂ ਫੋਨ ਵੀ ਨਹੀਂ ਕਿਸੇ ਨੂੰ ਕਰ ਸਕਦਾ ਸੀ ਨਾ ਹੀ ਨ ਮੈਂ ਨੈਟ ਦੀ ਵਰਤੋਂ ਕਰ ਸਕਦਾ ਸੀ ਅਤੇ ਬਹੁਤ ਮੁਸ਼ਕਿਲਾਂ ਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਲਈ ਮੈਂ ਤੈਅ ਕੀਤਾ ਕਿ ਪੰਜ ਸੌ ਅੱਸੀ ਰੁਪਏ ਦਾ ਰੀਚਾਰਜ ਦੋ ਜੋ ਕਿ ਦੋ ਮਹੀਨਿਆਂ ਦਾ ਹੋਣਾ ਹੈ ਮੈਂ ਆਪਣਾ ਮੋਬਾਈਲ ਨੰਬਰ ਛਿਆਨਵੇਂ ਚਾਰ ਸੌ ਪੈਂਹਠ ਪੰਦਰਾਂ ਸੱਤ ਸੌ ਚੌਂਤੀ ਨੰ ਉਸੇ ਨੰਬਰ 'ਤੇ ਮੈਂ ਰੀਚਾਰਜ ਮੈਂ ਕਰਾਉਣਾ ਚਾਹੁੰਦਾ ਹਾਂ ਅਤੇ ਬਹੁਤ ਸਾਰੀਆਂ ਮੁਸ਼ਕਿਲਾਂ ਆਈਆਂ ਅਤੇ ਮੈਂ ਰੀਚਾਰਜ ਖਤਮ ਹੋ ਗਿਆ ਸੀਗਾ ਮੇਰਾ ਮੈਂ ਦੁਬਾਰਾ ਰੀਚਾਰਜ ਕਰਨਾ ਚਾਹੁੰਦਾ ਸੀਗਾ ਉਹ ਮੇਰਾ ਹੋਇਆ ਨਹੀਂ ਕਿ ਰਿਚਾਰਜ ਨਾ ਹੋਣ ਕਰਕੇ ਬਹੁਤ ਸਾਰੀਆਂ ਮੁਸ਼ਕਿਲਾਂ ਆਈਆਂ ਕੰਮ ਕਾਰਾਂ ਦੀਆਂ ਕੋਈ ਫੋਟੋ ਵਗੈਰਾ ਸੈਂਡ ਕਰਨੀ ਹੁੰਦੀ ਆਪਦੇ ਦੋਸਤਾਂ ਨਾਲ ਨਾ ਗੱਲਬਾਤ ਕਰ ਸਕਿਆ ਕੰਮ ਤੋਂ ਵੀ ਬਹੁਤ ਸਾਰੇ ਸੰਪਰਕ ਟੁੱਟ ਗਏ ਮੇਰੇ ਕੰਮਾਂ ਦਾ ਵੀ ਨਸ ਨੁਕਸਾਨ ਹੋਇਆ ਰਿਚਾਰਜ ਬਹੁਤ ਇੱਕ ਵੱਡੀ ਬਹੁਤ ਸੁਵਿਧਾ ਹੈ ਜੋ ਕਿ ਮੋਬਾਈਲ ਵਿੱਚ ਵਰਤੋਂ ਕੀਤੀ ਜਾਂਦੀ ਹੈ ਇਸ ਤੋਂ ਬਿਨਾਂ ਕੋਈ ਮੋਬਾਈਲ ਕੋਈ ਕੰਮ ਦਾ ਨਹੀਂ ਇੱਕ ਡੱਬਾ ਹੀ